ਮੈਂ ਸ਼ੇਤਾ ਚਾਮ ਗੱਲ ਕਰ ਰਹੀ ਹਾਂ ਮੈਂ ਆਪਣੇ ਬਿਜਲੀ ਬਿੱਲ ਦਾ ਭੁਗਤਾਨ ਕਰ ਚੁੱਕੀ ਹਾਂ ਮੇਰੇ ਤੋਂ ਦੁਬਾਰਾ ਬਿਲ ਭਰਨ ਲਈ ਕਿਹਾ ਜਾ ਰਿਹਾ ਹੈ ਮੈਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਰੱਖਦੀ ਤੁਸੀਂ ਮੈਨੂੰ ਸਹਾਇਤਾ ਦੇ ਰੂਪ ਵਿੱਚ ਜਾਣਕਾਰੀ ਦਿਓ ਜਿਸ ਨਾਲ ਆਪਣੇ ਬਿੱਲ ਦੀ ਕਾਪੀ ਡਾਊਨਲੋਡ ਕਰ ਸਕਾਂ ਮੈਨੂੰ ਇਸ ਵੈਬਸਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਨੂੰ ਇਸ ਬਿਜਲੀ ਬੋਰਡ ਦੀ ਵੈਬਸਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਨੂੰ ਪਿਛਲੇ ਬਿਲ ਦੁਬਾਰਾ ਲੱਗ ਕੇ ਆ ਰਹੇ ਹਨ ਜੋ ਕਿ ਮੈਂ ਬਿੱਲ ਭਰ ਚੁੱਕੀ ਹਾਂ ਇਸ ਕਰਕੇ ਤੁਸੀਂ ਮੈਨੂੰ ਜਾਣਕਾਰੀ ਦੇ ਕੇ ਮੇਰੀ ਸਹਾਇਤਾ ਕਰੋ ਜਿਸ ਨਾਲ ਮੈਂ ਵੈਬਸਾਈਟ ਤੋਂ ਪੁਰਾਣੇ ਭਰੇ ਹੋਏ ਬਿਲ ਦੇ ਬਿੱਲ ਤੋਂ ਰਸੀਦਾਂ ਡਾਊਨਲੋਡ ਕਰ ਸਕਾਂ ਅਤੇ ਆਪਣੇ ਬਿਲ ਦੇ ਵਿੱਚ ਸੋਧ ਕਰਵਾ ਸਕਾਂ